ਮੇਰੀ ਗ੍ਰੈਜੂਏਸ਼ਨ ਦੇ ਫਾਈਨਲ ਈਅਰ ਵਿੱਚ ਅਸੀਂ ਇੱਕ ਸਰਵੇ ਕੀਤਾ ਜੋ ਕਿ ਗਰੀਬੀ ਗਰੀਬੀ ਲਈ ਸੀ ਜਿਸ ਵਿੱਚ ਗਰੀਬ ਲੋਕਾਂ ਦੀ ਜਨਗਣਨਾ ਕਰਨੀ ਸੀ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀ ਆਮਦਨ ਅਤੇ ਉਪਭੋਗਤਾ ਬਾਰੇ ਦੱਸਣਾ ਸੀ ਅਸੀਂ ਇਸ ਇਸ ਵਿੱਚ ਸਾਰਾ ਡਾਟਾ ਇਕੱਠਾ ਕੀਤਾ ਅੰਕੜਿਆਂ ਦਾ ਮੁਲਾਂਕਣ ਕੀਤਾ ਅਤੇ ਇਹ ਇਹ ਸਾਰਾ ਸਰਵੇ ਕਰਨ ਤੋਂ ਬਾਅਦ ਫਾਈਲ ਤਿਆਰ ਕਰਕੇ ਇਕਨਾਮਿਕਸ ਡਿਪਾਰਟਮੈਂਟ ਦੇ ਹੈੱਡ ਨੂੰ ਸੌਂਪ ਦਿੱਤੀ